ਹੈਲੋ ਹੈਲੋ ਹਾਂਜੀ ਹਾਂਜੀ ਅਸੀਂ ਉੱਥੇ ਬੋਲ ਰਹੇ ਹਾਂ ਅੱਛਾ ਜੀ ਹਾਂਜੀ ਉੱਦਣ ਨਾ ਡਾਕਟਰ ਛੁੱਟੀ 'ਤੇ ਸੀਗੇ ਉਹਨਾਂ ਨੂੰ ਕੋਈ ਐਮਰਜੈਂਸੀ ਆ ਗਈ ਸੀਗੀ ਅਤੇ ਅੱਜ ਤਾਂ ਦੇਖੋ ਦੋ ਵਜੇ ਤੋਂ ਹੋਸਪਿਟਲ ਬੰਦ ਹੋ ਜਾਊਗਾ ਅਤੇ ਮੈਂ ਤੁਹਾਨੂੰ ਰਿਕਮੈਂਡ ਨਹੀਂ ਕਰਦੀ ਕਿ ਤੁਸੀਂ ਅੱਜ ਆਓ ਅਤੇ ਕੱਲ੍ਹ ਨੂੰ ਸੰਡੇ ਆ ਮੈਂ ਤੁਹਾਨੂੰ ਇਹ ਹੀ ਕਹਿੰਦੀ ਹਾਂ ਕਿ ਤੁਸੀਂ ਪਰਸੋਂ ਆ ਜਾਇਓ ਹਾਂਜੀ ਤੁਹਾਨੂੰ ਪ੍ਰੋਬਲਮ ਕੀ ਸੀ ਅੱਛਾ ਜੀ ਅੱਛਾ ਹਾਂਜੀ ਕੱਲ੍ਹ ਤਾਂ ਦੇਖੋ ਕਰਿਓ ਨਾ ਅਤੇ ਹੌਲੀ ਹੌਲੀ ਇਲਾਜ ਦੇ ਹਿਸਾਬ ਨਾਲ ਤੁਹਾਡਾ ਇਲਾਜ ਹੋਊਗਾ ਐਂਡ ਬਹੁਤ ਸਾਰੇ ਤੁਹਾਡੇ ਪਹਿਲਾਂ ਟੈਸਟ ਕੀਤੇ ਜਾਣਗੇ ਅਤੇ ਫਿਰ ਉਸ ਤੋਂ ਬਾਅਦ ਚੋਂ ਡਾਕਟਰ ਸਲਾਹ ਕਰਕੇ ਦਵਾਈ ਦੇਣਗੇ ਹਾਂਜੀ ਡਾਕਟਰ ਦੀ ਫੀਸ ਸਲਿਪ ਦੀ ਫੀਸ ਟੂ ਹੰਡਰਡ ਹੈ ਅਤੇ ਉਸ ਤੋਂ ਬਾਅਦ ਜੋ ਟੈਸਟਾਂ ਦੀ ਫੀਸ ਆ ਉਹ ਲੈਬੋਰਟਰੀ ਵਾਲੇ ਤੁਹਾਨੂੰ ਦੱਸ ਦੇਣਗੇ ਐਂਡ ਜੋ ਦਵਾਈਆਂ ਹੋਣਗੀਆਂ ਤੁਸੀਂ ਬਾਹਰੋਂ ਨਹੀਂ ਲਓਗੇ ਹੋਸਪਿਟਲ ਦੇ ਵਿੱਚੋਂ ਕੋਈ ਐਵੇਂ ਦੀ ਦਵਾਈ ਨਹੀਂ ਮਿਲਦੀ ਹਾਂਜੀ ਪਹਿਲਾਂ ਤੁਹਾਡੇ ਸਾਰੇ ਟੈਸਟ ਹੋਣਗੇ ਫਿਰ ਆਪਾਂ ਨੂੰ ਉਹਦੇ ਵਿੱਚੋਂ ਹੀ ਪਤਾ ਲੱਗੂ ਕੇ ਤੁਹਾਨੂੰ ਬਿਮਾਰੀ ਕੀ ਆ ਉਸ ਹਿਸਾਬ ਨਾਲ ਤੁਹਾਡਾ ਇਲਾਜ ਸਟਾਰਟ ਕੀਤਾ ਜਾਊਗਾ ਹਾਂਜੀ ਡਾਕਟਰ ਦਸ ਵਜੇ ਤੋਂ ਦੋ ਵਜੇ ਤੱਕ ਬੈਠਦੇ ਆ ਅਤੇ ਬਾਰਾਂ ਤੋਂ ਸਾਢੇ ਬਾਰਾਂ ਤੱਕ ਲੰਚ ਟਾਈਮ ਹੁੰਦਾ ਅਤੇ ਤੁਸੀਂ ਪਹਿਲਾਂ ਕੋਈ ਟੈਸਟ ਕਰਵਾਇਆ ਹਾਂਜੀ ਉਹ ਟੈਸਟ ਦੀਆਂ ਜਿਹੜੀਆਂ ਸਾਰੀਆਂ ਇਮੇਜਿਸ ਆ ਜਾਂ ਰਿਪੋਰਟਸ ਨੇ ਉਹ ਸਾਰੀਆਂ ਨਾਲ ਹੀ ਚੁੱਕ ਲਿਆਇਓ ਐਂਡ ਤੁਸੀਂ ਮੈਂ ਕਹਿੰਦੀ ਹਾਂ ਕਿ ਉਸ ਤੋਂ ਪਹਿਲਾਂ ਆਪਣਾ ਬਲੱਡ ਟੈਸਟ ਕਰਵਾ ਲਿਓ ਅਤੇ ਬਾਰਾਂ ਤੋਂ ਪਹਿਲਾਂ ਪਹਿਲਾਂ ਤੁਸੀਂ ਆ ਜਾਇਓ ਅਤੇ ਭੀੜ ਭਾਵ ਬਹੁਤ ਹੁੰਦੀ ਆ ਅਤੇ ਉਸ ਤੋਂ ਪਹਿਲਾਂ ਤੁਸੀਂ ਆਪਣਾ ਬੁੱਕ ਕਰ ਦਿਓ ਤਾਂ ਜੋ ਤੁਹਾਨੂੰ ਕੋਈ ਪਰੇਸ਼ਾਨੀ ਨਾ ਆਵੇ ਪਰਚੀ ਵੀ ਪਹਿਲਾਂ ਹੀ ਕਟਾ ਲਿਓ ਓਕੇ ਥੈਂਕ ਯੂ